ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਓਕੇ ਅੱਛਾ ਜੀ ਤੁਸੀਂ ਮੈਨੂੰ ਆਪਣਾ ਨਾਮ ਦੱਸ ਸਕਦੇ ਹੋ ਪਲੀਜ਼ ਮਨਪ੍ਰੀਤ ਜੀ ਤੁਸੀਂ ਬੀਟੈਕ ਅਤੇ ਐੱਮਟੈਕ ਕਿਹੜੇ ਫੀਲਡ 'ਚ ਕੀਤੀ ਹੋਈ ਹੈ ਦੱਸੋਗੇ ਮੈਨੂੰ ਕੁਛ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਅਤੇ ਤੁਸੀਂ ਇਸ ਤੋਂ ਪਹਿਲਾਂ ਕੋਈ ਜੋਬ ਕੀਤੀ ਹੈ ਪਿੱਛੇ ਕੀ ਕਰਦੇ ਸੀ ਤੁਸੀਂ ਮੈਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋਗੇ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਅੱਛਾ ਫੇਰ ਮਨਪ੍ਰੀਤ ਜੇ ਤੁਹਾਡਾ ਇਹ ਐਕਸਪੀਰੀਅੰਸ ਹੈਗਾ ਤਾਂ ਮੈਂ ਤੁਹਾਨੂੰ ਇੱਕ ਦੱਸਣਾ ਚਾਹੂੰਗੀ ਵੀ ਸਾਡੇ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਨਾ ਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਕੋਲਜ ਹੈਗਾ ਬੜਾ ਵਧੀਆ ਅਤੇ ਨ ਅ ਉੱਨੀ ਸੌ ਛਿਆਨਵੇਂ ਦੇ ਵਿੱਚ ਬਣਿਆ ਸੀ ਕੋਲਜ ਅਤੇ ਇਹ ਕੋਲਜ ਸਾਡਾ ਬੜਾ ਰਿਨੋਂਡ ਹੈਗਾ ਨੈਕ ਐਨ ਬੀ ਏ ਪ੍ਰੋਪਰ ਹੋਈ ਹੋਈ ਹੈ ਅਤੇ ਇੱਥੇ ਇੱਕ ਓਪਰਚੁਨਟੀ ਹੁਣ ਹੈਗੀ ਆ ਸਾਡੇ ਕੋਲ ਸਾਡੇ ਕੋਲ ਮੌਕਾ ਹੈਗਾ ਅਤੇ ਕੋਲਜ ਦਾ ਕਾਫੀ ਨਾਮ ਵੀ ਹੈ ਅਤੇ ਸੈਲਰੀ ਵਗੈਰਾ ਬਹੁਤ ਵਧੀਆ ਦਿੰਦੇ ਨੇ ਇਹ ਇੱਥੇ ਇੱਕ ਜਿਹੜੀ ਹੈਗੀ ਆ ਜੋਬ ਨਿਕਲੀ ਹੋਈ ਆ ਆਪਣਾ ਅਸਿਸਟੈਂਟ ਪ੍ਰੋਫੈਸਰ ਦੀ ਸਿਵਲ ਇੰਜਨੀਅਰ ਡਿਪਾਰਟਮੈਂਟ ਦੇ ਵਿੱਚੇ ਅਤੇ ਜੇ ਤੁਸੀਂ ਚਾਹੋ ਤਾਂ ਚੌਤੀ ਹਜ਼ਾਰ ਇੱਕ ਸੌ ਸਕੇਲ ਹੈਗਾ ਅਤੇ ਰੈਗੂਲਰ ਜੋਬ ਹੈ ਅਤੇ ਦੋ ਸਾਲ ਪ੍ਰੋਬੇਸ਼ਨ ਦਾ ਟਾਈਮ ਹੁੰਦਾ ਅਤੇ ਜੇ ਤੁਸੀਂ ਚਾਹੋ ਤਾਂ ਇੱਥੇ ਤੁਹਾਨੂੰ ਮੌਕਾ ਮਿਲ ਸਕਦਾ ਸਾਡੀ ਜਿਹੜੀ ਹੈਗੀ ਹੈ ਪਿਛਲਾ ਜੋਬ ਪ੍ਰੋਫਾਈਲ ਹੈ ਜਿਹੜੀ ਉਹ ਵੀ ਖਾਸੀ ਮੈਚ ਕਰਦੀ ਹੈ ਅਤੇ ਉਹਨਾਂ ਨੂੰ ਲੋੜ ਵੀ ਹੈ ਪਰ ਉਹਦੇ 'ਚ ਕੰਡੀਸ਼ਨ ਇਹ ਆ ਵੀ ਤੁਹਾਨੂੰ ਮ ਪੰਦਰਾਂ ਦਿਨ ਦੇ ਵਿੱਚ ਵਿੱਚ ਜੁਆਇਨ ਕਰਨਾ ਪਊਗਾ ਤੁਹਾਨੂੰ ਉੱਦਾਂ ਦਾ ਤਾਂ ਕੋਈ ਨਹੀਂ ਚੱਕਰ ਹੈਗਾ ਠੀਕ ਹੈ ਜੀ ਓਕੇ ਓਕ